ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂ ਸਰ ਜੇ ਅਤੇ ਮੈਂ ਮੇਰਾ ਜੋ ਆਪਣਾ ਓਪੀਨੀਅਨ ਹੈ ਕਿ ਸਾਡੇ ਪੰਜਾਬ ਵਿੱਚ ਖ਼ਾਸ ਕਰਕੇ ਗੁਰਦਾਸਪੁਰ ਦੇ ਵਿੱਚ ਜਿਹੜਾ ਸਿੱਖਿਆ ਦਾ ਪੱਧਰ ਆ ਜੋ ਮੈਨੂੰ ਲੱਗਦਾ ਕਿ ਪਹਿਲਾਂ ਨਾਲੋਂ ਕਾਫੀ ਉੱਚਾ ਹੋਇਆ ਵਾ ਉਹਦਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਦੀ ਹਾਲਤ ਅੱਗੇ ਨਾਲੋਂ ਕਾਫੀ ਸੁਧਰੀ ਹੈ ਜਿਵੇਂ ਅ ਬੱਚਿਆਂ ਨੂੰ ਅੱਠਵੀਂ ਕਲਾਸ ਤੱਕ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਜਿਹੜੀ ਪ੍ਰਦਾਨ ਕੀਤੀ ਸਰਕਾਰ ਨੇ ਉਹਦੇ 'ਤੇ ਤਾਂ ਬੱਚਿਆਂ ਦਾ ਜਿਹੜਾ ਵਾ ਸਰਬਪੱਖੀ ਵਿਕਾਸ ਹੋ ਰਿਹਾ ਵਾ

ਸਰ ਮੇਰੇ ਮੁਤਾਬਿਕ ਮੈਂ ਸਮਝ ਗਿਆ ਤੁਹਾਡਾ ਕੁਸਚਨ ਸਰ ਮੈਨੂੰ ਲੱਗਦਾ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਹੁਣ ਪੰਜਾਬ ਦੇ ਵਿੱਚ ਵੈਸੇ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਮੈਨੂੰ ਨਹੀਂ ਲੱਗਦਾ ਹੋਣਗੀਆਂ ਜੇ ਹੋਣਗੀਆਂ ਵੀ ਤਾਂ ਕੋਈ ਇੱਕ ਦੋ ਪਰਸੈਂਟ ਵੀ ਹੋਣਗੀਆਂ ਲੇਕਿਨ ਉਹਨਾਂ 'ਤੇ ਵੀ ਕੰਮ ਚੱਲ ਰਿਹਾ ਹੋਏਗਾ ਕਿਉਂਕਿ ਜਿੱਥੋਂ ਤੱਕ ਮੈਨੂੰ ਨੌਲੇਜ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਸਕੂਲਾਂ ਦੇ ਸਿੱਖਿਆ ਪ੍ਰਗਤੀ ਆ ਉਹਦੇ ਸੁਧਾਰ 'ਤੇ ਕਾਫੀ ਧਿਆਨ ਦਿੱਤਾ ਉਹ ਹਰ ਇੱਕ ਸਕੂਲ ਨੂੰ ਅੱਛੇ ਤਰੀਕੇ ਨਾਲ ਗਰਾਂਟ ਵਗੈਰਾ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਔਰ ਉਸ ਗਰਾਂਟ ਦੇ ਤਹਿਤ ਮੈਨੂੰ ਲੱਗਦਾ ਵੀ ਪੰਜਾਬ ਦੇ ਸਕੂਲਾਂ ਦਾ ਜਿਹੜਾ ਸਿੱਖਿਆ ਦਾ ਮਿਆਰ ਆ ਉਹ ਕਾਫੀ ਉੱਚਾ ਚੁੱਕਿਆ ਜਾ ਰਿਹਾ ਜਿਹਦੇ ਨਾਲ ਬੱਚਿਆਂ ਨੂੰ ਬੜੀਆਂ ਅੱਛੀਆਂ ਸਹੂਲਤਾਂ ਮਿਲ ਰਹੀਆਂ ਜਿਵੇਂ ਅਸੀਂ ਦੇਖਦੇ ਹਾਂ ਕਿ ਬੱਚਿਆਂ ਨੂੰ ਮਿੱਡੇ ਮੀਲ ਸਕੂਲਾਂ ਦੇ ਵਿੱਚ ਖਾਣਾ ਮਿਲ ਰਿਹਾ ਵਾ ਔਰ ਬੱਚਿਆਂ ਨੂੰ ਖੇਡਣ ਦਾ ਸਮਾਨ ਸਪੋਰਟਸ ਦਾ ਸਮਾਨ ਉਹ ਸਾਰੀਆਂ ਚੀਜ਼ਾਂ ਔਰ ਅਧਿਆਪਕਾਂ ਦੀ ਗਿਣਤੀ ਦਿਨੋਂ ਦਿਨ ਸਕੂਲਾਂ 'ਚ ਵੱਧ ਰਹੀ ਹੈ ਜਿਹਦੇ ਕਰਕੇ ਮੈਨੂੰ ਲੱਗਦਾ ਜਿਹੜੀਆਂ ਤੁਸੀਂ ਅ ਚੀਜ਼ਾਂ ਕਹਿ ਰਹੇ ਹੋ ਇਹ ਥੋੜ੍ਹੀਆਂ ਬਹੁਤੀਆਂ ਹੋਣਗੀਆਂ ਲੇਕਿਨ ਉਹਨਾਂ ਵਿੱਚ ਵੀ ਅੱਗੇ ਕਾਫੀ ਸੁਧਾਰ ਆ ਰਹੇ ਨੇ

ਨਹੀਂ ਨਹੀਂ ਸਰ ਇਹ ਨਾ ਮੈਨੂੰ ਲੱਗਦਾ ਇਹ ਤਾਂ ਤੁਹਾਡੇ ਵਰਗੇ ਜਿਹੜੇ ਨਿਊਜ਼ ਚੈਨਲ ਉਹ ਐਵੇਂ ਝੂਠੀਆਂ ਖ਼ਬਰਾਂ ਫੈਲਾ ਦਿੰਦੇ ਸਰ ਐਕਚੁਅਲ 'ਚ ਇਹ ਜਿਹੜਾ ਅਧਿਕ ਅਧਿਆਪਕ ਆ ਉਹ ਆਪਣੇ ਬੱਚਿਆਂ ਨਾਲ ਕਦੇ ਵੀ ਵਿਤਕਰਾ ਨਹੀਂ ਕਰ ਸਕਦਾ ਔਰ ਬੱਚਿਆਂ ਦਾ ਕਦੇ ਵੀ ਹੱਕ ਨਹੀਂ ਖਾ ਸਕਦਾ ਔਰ ਜਿਹੜੇ ਪਿੰਡਾਂ ਦੇ ਸਰਪੰਚ ਨੇ ਅੱਜ ਕੱਲ੍ਹ ਉਹ ਵੀ ਪੜ੍ਹੇ ਲਿਖੇ ਨੇ ਉਹ ਵੀ ਸਕੂਲ ਦਾ ਪੂਰਾ ਧਿਆਨ ਰੱਖਦੇ ਨੇ ਸੋ ਮੈਨੂੰ ਲੱਗਦਾ ਵੀ ਠੀਕ ਸਾਰਾ ਸਿਸਟਮ ਚੱਲ ਰਿਹਾ ਸਕੂਲਾਂ ਦੇ ਵਿੱਚ ਔਰ ਜਿਹੜੀਆਂ ਇਹੋ ਜਿਹੀਆਂ ਅਫਵਾਵਾਂ ਉੱਡੀਆਂ ਉਹਨਾਂ ਵੱਲ ਸਾਨੂੰ ਘੱਟ ਧਿਆਨ ਦੇਣਾ ਚਾਹੀਦਾ ਸਰ ਠੀਕ ਆ ਸਰ ਬਹੁਤ ਬਹੁਤ ਧੰਨਵਾਦ ਜੀ ਓਕੇ ਓਕੇ ਸਰ ਓਕੇ